ਮੇਰੇ ਪਸੰਦੀਦਾ ਪੰਛੀ ਬਹੁਤ ਸਾਰੇ ਹੈ ਮੈਨੂੰ ਸਾਰੇ ਹੀ ਪੰਛੀ ਬਹੁਤ ਜ਼ਿਆਦਾ ਪਸੰਦ ਹੈ ਜਿਵੇਂ ਕਿ ਪੰਛੀਆਂ ਦਾ ਝੁੰਡ ਇਕੱਠਾ ਬੈਠਾ ਹੁੰਦਾ ਜਦੋਂ ਸਵੇਰੇ ਸਵੇਰੇ ਉੱਠੋ ਤਾਂ ਪੰਛੀਆਂ ਦੀ ਚਹਿਚਹਾਟਾਂ ਦੀ ਆਵਾਜ਼ ਆਉਂਦੀ ਹੈ ਤਾਂ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਪੰਛੀਆਂ ਦੀ ਆਵਾਜ਼ਾਂ ਬੜੀਆਂ ਹੀ ਪਿਆਰੀਆਂ ਲੱਗਦੀਆਂ ਹਨ ਝੁੰਡ 'ਚ ਬੈਠੇ ਜਾਂ ਆਲ੍ਹਣਾ ਵੀ ਬਣਿਆ ਹੋਵੇ ਤਾਂ ਵੀ ਪੰਛੀ ਚੀਂ ਚੀਂ ਕਰਦੇ ਬੜੇ ਹੀ ਪਿਆਰੇ ਲੱਗਦੇ ਹਨ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਹੀ ਸੋਹਣੀਆਂ ਹਨ ਤੋਤਾ ਤਾਂ ਬਹੁਤ ਹੀ ਪਿਆਰ ਨਾਲ ਬੋਲਦਾ ਹੈ ਪੰਛੀ ਹਮੇਸ਼ਾ ਹੀ ਬਹੁਤ ਹੀ ਅੱਛੇ ਹਨ ਪੰਛੀਆਂ ਨੂੰ ਦੇਖ ਕੇ ਇੱਕ ਅਲੱਗ ਤਰ੍ਹਾਂ ਦੀ ਐਨਰਜੀ ਮਹਿਸੂਸ ਹੁੰਦੀ ਹੈ ਜਿਵੇਂ ਕਿ ਇਹ ਬਹੁਤ ਜ਼ਿਆਦਾ ਹੀ ਅੱਛੇ ਹੈ ਜਦੋਂ ਪੰਛੀ ਦਾਣਾ ਚੁਗਦੇ ਹਨ ਤਾਂ ਬਹੁਤ ਜ਼ਿਆਦਾ ਹੀ ਸੋਹਣੇ ਲੱਗਦੇ ਹੁੰਦੇ ਹੈ ਪੰਛੀ ਸਾਡੇ ਇੱਕ ਜੀਵਨ ਦਾ ਹਿੱਸਾ ਬਣ ਚੁੱਕੇ ਹਨ ਪੰਛੀਆਂ ਤੋਂ ਬਿਨਾ ਸਾਡਾ ਜੀਵਨ ਨਹੀਂ ਚੱਲ ਸਕਦਾ ਅਸੀਂ ਪੰਛੀਆਂ ਨਾਲ ਬਹੁਤ ਜ਼ਿਆਦਾ ਲਗਾਵ ਕਰਦੇ ਹਾਂ ਪੰਛੀ ਹੀ ਬਹੁਤ ਜ਼ਿਆਦਾ ਅੱਛੇ ਹੁੰਦੇ ਹਨ ਪੰਛੀ ਆਪਣਾ ਆਲ੍ਹਣਾ ਬਹੁਤ ਸੋਹਣਾ ਬਣਾਉਂਦੇ ਹਨ ਉਹਦੇ ਵਿੱਚ ਆਪਣਾ ਆਪਣੇ ਆਪ ਨੂੰ ਬਹੁਤ ਸੋਹਣਾ ਸਜਾ ਕੇ ਰੱਖਦੇ ਹਨ ਪੰਛੀਆਂ ਦਾ ਆਪਣਾ ਆਰ ਵਿਹਾਰ ਬਹੁਤ ਜ਼ਿਆਦਾ ਅੱਛਾ ਹੁੰਦਾ ਹੈ ਪੰਛੀ ਹੀ ਪੰਛੀਆਂ ਨੂੰ ਜਦੋਂ ਸ਼ਾਮ ਨੂੰ ਵਾਪਸ ਘਰ ਪਰਤਦੇ ਹਨ ਤਾਂ ਝੁੰਡਾਂ ਦੇ ਝੁੰਡ ਜਾਂਦੇ ਹੀ ਬਹੁਤ ਜ਼ਿਆਦਾ ਅੱਛੇ ਲੱਗਦੇ ਹਨ ਪੰਛੀਆਂ 'ਚ ਆਪਸੀ ਪ੍ਰੇਮ ਬਹੁਤ ਜ਼ਿਆਦਾ ਹੁੰਦਾ ਹੈ ਪੰਛੀ ਇੱਕ ਦੂਜੇ ਨੂੰ ਦੇਖ ਕੇ ਬਹੁਤ ਜ਼ਿਆਦਾ ਹੀ ਖੁਸ਼ ਹੁੰਦੇ ਜਦੋਂ ਜਦੋਂ ਇਹ ਇਕੱਠੇ ਹੁੰਦੇ ਹਨ ਤਾਂ ਇਹਨਾਂ ਵਿੱਚ ਇੱਕ ਆਪਣਾ ਹੀ ਇਕਾਗਰਤਾ ਹੁੰਦੀ ਹੈ ਉਹ ਇਕਾਗਰਤਾ ਬਹੁਤ ਜ਼ਿਆਦਾ ਹੀ ਸੋਹਣੀ ਹੁੰਦੀ ਹੈ ਧੰਨਵਾਦ